ਗੁੱਡ ਆਫਟਰਨੂੰਨ ਜੀ ਹਾਂਜੀ ਇਹ ਤਾਂ ਦੇਖੋ ਇਹ ਤਾਂ ਸਾਰਿਆਂ ਨੂੰ ਕਲਾਸਾਂ ਲੈਣੀਆਂ ਹੀ ਪੈਣੀਆਂ ਨੇ ਇਹਦੇ ਵਿੱਚ ਆਪਾਂ ਕੋਈ ਇਹ ਨਹੀਂ ਦੇਖ ਸਕਦੇ ਕਿ ਕਦੋਂ ਲੈਣੀਆਂ ਇਹ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਕਲਾਸ ਟਾਈਮ ਟੇਬਲ ਆਪਾਂ ਬਣਾਉਂਦੇ ਹਾਂ ਹੈ ਨਾ ਅਤੇ ਇਹਦੇ ਵਿੱਚ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਸਵੇਰੇ ਨਹੀਂ ਕਲਾਸ ਲੈ ਸਕਦਾ ਜਾਂ ਕਿ ਸ਼ਾਮ ਨੂੰ ਨਹੀਂ ਲੈ ਸਕਦਾ ਹੈ ਨਾ ਇਹ ਤਾਂ ਦੇਖੋ ਸਾਰਿਆਂ ਦਾ ਦੇਖ ਕੇ ਕਲਾਸਾਂ ਦੀ ਅਵੇਬਿਲਟੀ ਦੇਖ ਕੇ ਆਪਾਂ ਫਿਰ ਹੀ ਟਾਈਮ ਟੇਬਲ ਬਣਦਾ ਅਤੇ ਤੁਸੀਂ ਜੇ ਚਲੋ ਠੀਕ ਹੈ ਗੋਪਾਲ ਜੀ ਸੋ ਇਸ ਸਮੈਸਟਰ ਮੈਂ ਤੁਹਾਡਾ ਇਸ ਗੱਲ ਦਾ ਧਿਆਨ ਰੱਖੂੰਗਾ ਬਟ ਇਹ ਹਰ ਵਾਰ ਨਾ ਇਹ ਗੱਲ ਆਪਾਂ ਨੂੰ ਸੁਣਨ ਮਿਲੇ ਕਿ ਵੀ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਹੈ ਚਲੋ ਇਸ ਸੈਮਸਟਰ ਦੇ ਵਿੱਚ ਮੈਂ ਤੁਹਾਡਾ ਦੇਖਦਾ ਜੋ ਹੋ ਸਕਦਾ ਬੈਸਟ ਮੈਂ ਤੁਹਾਡਾ ਜੇ ਪਹਿਲਾ ਲੈਕਚਰ ਤੁਹਾਡਾ ਫਰੀ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਠੀਕ ਹੈ ਅਤੇ ਅੱਗੇ ਤੋਂ ਬਾਕੀ ਕੋਸ਼ਿਸ਼ ਕਰੋ ਤੁਸੀਂ ਟਾਈਮ ਸਿਰ ਆਓ ਕਿਉਂਕਿ ਬਾਕੀ ਹੋਰ ਵੀ ਫਿਰ ਕੰਪਲੇਂਟ ਕਰ ਦਿੰਦੇ ਇਸ ਬਾਰੇ